ਮੈਂ ਹਲੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਹਾਂ ਜੋ ਕਿ ਮੈਂ ਮੈਡੀਕਲ ਤੋਂ ਕਰ ਰਹੀ ਹਾਂ ਅਤੇ ਅੱਗੇ ਜਿਹੜਾ ਮੈਂ ਆਪਣੀ ਪੜ੍ਹਾਈ ਕੰਟੀਨਿਊ ਕਰਨਾ ਚਾਹੁੰਦੀ ਹਾਂ ਉਹ ਮੈਂ ਡਾਕਟਰੀ ਲਇਨ ਵਿੱਚ ਕੰਟੀਨਿਊ ਕਰਨਾ ਚਾਹੁੰਦੀ ਹਾਂ ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਅਸੀਂ ਕਿਤੇ ਵੀ ਅਸੀਂ ਥੋੋੜ੍ਹੇ ਜਿਹੇ ਵੀ ਬਿਮਾਰ ਹੋ ਜਾਈਏ ਸਾਨੂੰ ਡੋਕਟਰ ਕੋਲ ਜਾਣਾ ਪੈਂਦਾ ਅਤੇ ਡੋਕਟਰ ਐਡੇ ਵੱਡੇ ਵੱਡੇ ਬਿੱਲ ਫਾੜ ਕੇ ਦੇ ਦਿੰਦੇ ਨੇ ਕਿਉਂਕਿ ਹਰੇਕ ਬੰਦਾ ਓਹ ਬਿੱਲ ਨਹੀਂ ਪੜ੍ਹ ਸਕਦਾ ਤਾਂ ਮੈਂ ਪੜ੍ਹ ਮੈਂ ਪੜ੍ਹਾਈ ਕਰਕੇ ਇੱਕ ਉਹਨਾਂ ਲੋਕਾਂ ਵਾਸਤੇ ਹੋਸਪਿਟਲ ਖੋਲੂੰਗੀ ਕਿ ਜਿਹਨੂੰ ਹਰੇਕ ਬੰਦਾ ਆ ਸਕੇ ਤਾਂ ਓਹ ਉੱਥੇ ਆਪਣਾ ਇਲਾਜ ਕਰਾ ਸਕੇ ਅਤੇ ਉਹਨੂੰ ਇੰਨਾਂ ਖਰਚਾ ਵੀ ਨਾ ਪਵੇ ਮੈਂ ਇਹੋ ਜੀ ਡਾਕਟਰ ਬਣਨਾ ਚਾਹੁੰਦੀ ਹਾਂ ਜੋ ਕਿ ਸਿਰਫ ਪੈਸਿਆਂ ਪਿੱਛੇ ਨਹੀਂ ਬੰਦਿਆਂ ਦੀ ਜਾਨ ਬਚਾਉਣ ਲਈ ਵੀ ਕੁਛ ਕਰ ਸਕੇ ਮੈਂ ਸਭ ਦੀ ਮਦਦ ਕਰਨਾ ਚਾਹੁੰਦੀ ਹਾਂ ਮੈਨੂੰ ਇਹ ਕੋਈ ਲਾਲਚ ਨਹੀਂ ਹੈਗਾ ਕਿ ਡੋਕਟਰ ਬਣ ਕੇ ਪੈਸੇ ਕਮਾਉਣੇ ਨੇ ਜਾਂ ਇੱਦਾਂ ਦਾ ਕੁਛ ਹੈ ਬਸ ਮੈਂ ਲੋਕਾਂ ਦੀ ਜ ਜਿੰਨੀ ਤੋਂ ਜਿੰਨੀ ਜ਼ਿਆਦਾ ਹੋ ਸਕਦੀ ਆ ਜੀਵਨ ਦਾਨ ਦੇਣਾ ਚਾਹੁੰਦੀ ਹਾਂ ਪਰ ਕਿਉਂਕਿ ਅੱਜ ਕੱਲ੍ਹ ਲੋਕ ਕਹਿੰਦੇ ਵੀ ਨੇ ਕਿ ਦੁਨੀਆਂ 'ਚ ਸਾਰੇ ਇਨਸਾਨ ਭੁੱਖੇ ਮਰ ਸਕਦੇ ਨੇ ਪਰ ਇੱਕ ਡੋਕਟਰ ਕਦੇ ਭੁੱਖਾ ਨਹੀਂ ਮਰ ਸਕਦਾ ਜੋ ਕਿ ਇੱਕ ਹੱਦ ਤੱਕ ਸੱਚ ਵੀ ਹੈਗਾ ਹੈ ਕਿਉਂਕਿ ਦੁਨੀਆਂ 'ਚ ਇਹ ਜਿਹਾ ਕੋਈ ਬੰਦਾ ਨਹੀਂ ਜਿਹਨੂੰ ਕੋਈ ਨਾ ਕੋਈ ਬਿਮਾਰੀ ਨਾ ਹੋਵੇ ਕਿਸੇ ਨੂੰ ਖਾਸੀ ਜ਼ੁਕਾਮ ਕਦੇ ਨਾ ਕਦੇ ਬੁਖਾਰ ਤਾਂ ਹਰੇਕ ਨੂੰ ਹੀ ਹੁੰਦਾ ਹੈ ਇਸ ਕਰਕੇ ਮੈਂ ਡੋਕਟਰ ਲਾਇਨ ਵਿੱਚ ਜਾਣਾ ਚਾਹੁੰਦੀ ਹਾਂ ਅਤੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਹਾਂ